ਵੈਸੇ ਅੱਜ ਕੱਲ੍ਹ ਲੋਕ ਬਹੁਤ ਹੀ ਜ਼ਿਆਦਾ ਆਧੁਨਿਕ ਹੋ ਗਏ ਹਨ ਅਤੇ ਵਿਸ਼ਵੀਕਰਨ ਦੇ ਕਰਕੇ ਲੋਕ ਜਿਹੜੇ ਹੈਗੇ ਚਾਹੇ ਜਿੱਥੇ ਤੱਕ ਵੀ ਪਹੁੰਚ ਗਏ ਹਨ ਲੇਕਿਨ ਜਿੰਨੇ ਮਰਜ਼ੀ ਚਾਹੇ ਉਹ ਆਧੁਨਿਕ ਹੋ ਗਏ ਹਨ ਲੇਕਿਨ ਜਿਹੜੇ ਹੈਗੇ ਉਹ ਆਪਣੇ ਜਦੋਂ ਕੋਈ ਉਹਨਾਂ ਦਾ ਖਾਸ ਮੌਕੇ ਆਉਂਦੇ ਹਨ ਚਾਹੇ ਜਨਮ ਦੇ ਸਮੇਂ ਉਹਨਾਂ ਦੇ ਵਿਆਹ ਸ਼ਾਦੀਆਂ ਦੇ ਸਮੇਂ ਤਾਂ ਉਨ੍ਹਾਂ ਦੀ ਇਹੀ ਦਿਲੀ ਇੱਛਾ ਹੁੰਦੀ ਹੈ ਕਿ ਜੋ ਸਾਡੇ ਪੁਰਾਣੇ ਟਾਇਮ ਤੋਂ ਚੱਲੇ ਆ ਰਹੇ ਪਰੰਪਰਾਵਾਂ ਹਨ ਸਾਡੇ ਰੀਤੀ ਰਿਵਾਜ਼ ਹਨ ਤਾਂ ਅਸੀਂ ਆਪਣੇ ਜਿਹੜੇ ਇਹ ਹੈਗੇ ਹੈ ਕੋਈ ਵੀ ਫੰਕਸ਼ਨ ਹੈਗੇ ਹੈ ਅਸੀਂ ਉਹਨਾਂ ਦੇ ਅਨੁਸਾਰ ਹੀ ਕਰੀਏ ਇਸ ਕਰਕੇ ਇਹਨਾਂ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੇ ਇਹਨਾਂ ਸਾਰੇ ਸਮਾਗਮਾਂ ਨੂੰ ਕਰਦੇ ਹਾਂ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਅਸੀਂ ਆਪਣੇ ਉਹੀ ਮਤਲਬ ਜਿੰਨੇ ਮਰਜ਼ੀ ਚਾਹੇ ਅਸੀਂ ਮੌਡਰਨ ਹੋ ਜਾਈਏ ਜਦੋਂ ਅਸੀਂ ਇਹਨਾਂ ਪਰੰਪਰਾਵਾਂ ਨੂੰ ਆਪਣਿਆਂ ਨੂੰ ਕਾਇਮ ਰੱਖਦੇ ਹਾਂ ਇਹਨਾਂ ਮਤਲਬ ਪੁਰਾਣੇ ਰੀਤੀ ਰਿਵਾਜ਼ਾਂ ਦੇ ਅਨੁਸਾਰ ਹੀ ਆਪਣੀਆਂ ਵਿਆਹ ਸ਼ਾਦੀਆਂ ਜਾਂ ਫਿਰ ਆਪਾਂ ਕੋਈ ਵੀ ਆਪਣੇ ਅਸੀਂ ਫੰਕਸ਼ਨ ਕਰਦੇ ਹਾਂ ਤਾਂ ਸਾਡੇ ਜਿਹੜੇ ਪੁਰਾਣੇ ਸੱਭਿਆਚਾਰਕ ਪਰੰਪਰਾਵਾਂ ਹਨ ਉਹ ਕਾਇਮ ਰੱਖ ਰੱਖ ਰੱਖੀਆਂ ਜਾ ਸਕਦੀਆਂ ਹਨ ਕਿਉਂਕਿ ਅਸੀਂ ਅਗਰ ਇਹਨਾਂ ਨੂੰ ਭੁਲਾ ਦਊਗੇ ਇਨ੍ਹਾਂ ਪਰੰਪਰਾਵਾਂ ਤੋਂ ਬਾਹਰ ਨਿਕਲ ਕੇ ਅਸੀਂ ਬਿਲਕੁਲ ਇੱਕ ਦੂਸਰੀ ਸੱਭਿਅਤਾ ਦੇ ਵਿੱਚ ਜਾ ਕੇ ਅਸੀਂ ਕਰਦੇ ਹਾਂ ਤਾਂ ਫਿਰ ਇਹ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹ ਕੀਤੇ ਖੋ ਜਾਣਗੀਆਂ ਲੇਕਿਨ ਸਭ ਦੀ ਜਿਹੜੀ ਦਿਲੀ ਇੱਛਾ ਇਹ ਹੁੰਦੀ ਹੈ ਅਤੇ ਅਸੀਂ ਅਗਰ ਇਹਨਾਂ ਪਰੰਪਰਾਵਾਂ ਦੇ ਵਿੱਚ ਜਾ ਕੇ ਆਪਣੇ ਸਾਰੇ ਆਪਣੇ ਜਿਹੜੇ ਕਾਰਜ ਕਰੀਏ ਤਾਂ ਸਾਡੇ ਪੁਰਾਣੇ ਜਿਹੜੇ ਹੈਗੇ ਹੈ ਸੱਭਿਆਚਾਰਕ ਪਰੰਪਰਾਵਾਂ ਇਹ ਕਿਤੇ ਨਹੀਂ ਜਾ ਸਕਦੀਆਂ ਇਹ ਸਾਰੀ ਜ਼ਿੰਦਗੀ ਕਾਇਮ ਰਹਿ ਸਕਦੀਆਂ ਹਨ